ਮੈਨੂੰ ਫੋਟੋ ਖਿੱਚਣਾ ਬਹੁਤ ਪਸੰਦ ਹੈ ਅਤੇ ਜਦ ਮੈਂ ਆਪਣਾ ਨਵਾਂ ਫੋਨ ਲਿੱਤਾ ਸੀਗਾ ਅਤੇ ਮੈਂ ਉਹਦੇ ਵਿੱਚ ਵੀ ਬਹੁਤ ਆਪਣੀਆਂ ਫੋਟੋਆਂ ਖਿੱਚੀਆਂ ਪਰ ਮੈਨੂੰ ਇੰਨਾਂ ਚੰਗੀ ਤਰ੍ਹਾਂ ਫੋਟੋ ਖਿੱਚਣਾ ਆਉਂਦੀਆ ਨਹੀਂ ਸੀਗੀ ਅਤੇ ਫਿਰ ਮੈਂ ਆਪਣੇ ਯੂਟਿਊਬ 'ਤੇ ਕੈਮਰਾ ਦੀਆਂ ਮਤਲਬ ਫੋਨ ਦੀਆਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਕਿੱਦਾਂ ਖਿੱਚਦੇ ਹਨ ਕਿੱਦਾਂ ਨਹੀਂ ਅਤੇ ਮੈਂ ਐਡਟਿੰਗ ਕਰਨੀ ਸਿੱਖੀ ਅਤੇ ਜਦ ਮੈਨੂੰ ਹੌਲੀ ਹੌਲੀ ਐਡਟਿੰਗ ਕਰਨੀ ਆਈ ਫੋਟੋਆਂ ਖਿੱਚਣੀਆਂ ਚੰਗੀ ਤਰ੍ਹਾਂ ਆਈ ਅਤੇ ਫਿਰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਦਿਖਾਇਆ ਅਤੇ ਫਿਰ ਮਤਲਬ ਉਹਨਾਂ ਨੂੰ ਵੀ ਬਹੁਤ ਚੰਗੀ ਲੱਗੀ ਅਤੇ ਜਦ ਵੀ ਉਹਨਾਂ ਨੂੰ ਮੇਰੇ ਕੋਲੋਂ ਫੋਟੋਆਂ ਖਿਚਾਉਣੀ ਹੋਵੇ ਤਾਂ ਉਹ ਮੇਰੇ ਕੋਲ ਖਿਚਾਉਂਦੇ ਹਨ ਅਤੇ ਅਤੇ ਮੇਰੇ ਕੋਲ ਐਡਿਟ ਕਰਾਉਂਦੇ ਹਨ ਅਤੇ ਜਿੱਦਾਂ ਕਿ ਮਤਲਬ ਲੋਕ ਅੱਜ ਮਤਲਬ ਪ੍ਰੀ ਵੈਡਿੰਗ ਵਾਸਤੇ ਫੋਟੋਸ਼ੂਟ ਕਰਦੇ ਆ ਪ੍ਰੋਫੈਸ਼ਨਲ ਕਰਦੇ ਆ ਪਰ ਮੈਂ ਮਤਲਬ ਕਹਿਣਾ ਚਾਹੁੰਦਾ ਕਿ ਮੈਂ ਪ੍ਰੋਫੈਸ਼ਨਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਵਾਸਤੇ ਮਹਿੰਗੇ ਮਹਿੰਗੇ ਸਮਾਨ ਖਰੀਦਣੇ ਪੈਂਦੇ ਨੇ ਕੈਮਰਾ ਖਰੀਦਣੇ ਪੈਂਦੇ ਹਨ ਅਤੇ ਅਲੱਗ ਤੋਂ ਵੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਕਿ ਮਤਲਬ ਮਹਿੰਗੀਆਂ ਹੁੰਦੀਆਂ ਅਤੇ ਮੈਂ ਖਰੀਦ ਨਹੀਂ ਸਕਦਾ ਅਤੇ ਮਤਲਬ ਇਹਨਾਂ ਚੀਜ਼ਾਂ ਏ ਕਿ ਮਤਲਬ ਉਹਦੇ ਵਾਸਤੇ ਬੰਦੇ ਬੁੰਦੇ ਵੀ ਰੱਖਣੇ ਪੈਂਦੇ ਆ ਅਤੇ ਮਤਲਬ ਫਿਰ ਪ੍ਰੀ ਵੈਡਿੰਗ ਵਾਸਤੇ ਤਾਂ ਜੀ ਟਾਇਮ ਵੀ ਚਾਹੀਦਾ ਹੁੰਦਾ ਏ ਅਤੇ ਗੱਡੀ ਚਾਹੀਦੀ ਹੁੰਦੀ ਸਮਾਨ ਸਮੁਨ ਰੱਖਣ ਨੂੰ ਅਤੇ ਮੈਂ ਮਤਲਬ ਇੰਨਾਂ ਜੋਗਾ ਹੈ ਨਹੀਂ ਕਿ ਜੀ ਮੈਂ ਇੰਨਾਂ ਕੁਛ ਕਰਾਂ ਮੈਨੂੰ ਫੋਨ 'ਚ ਫੋਟੋਆਂ ਖਿੱਚਣੀਆਂ ਜ਼ਿਆਦਾ ਪਸੰਦ ਹੈ ਅਤੇ ਮੈਂ ਫੋਨ 'ਚ ਏ ਖਿੱਚ ਸਕਦਾ ਏ ਜੀ